ਮੈਂ ਅੰਸ਼ੁਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਜਿਵੇਂ ਸਾਡੇ ਸਥਾਨ ਦੇ ਸਥਾਨਕ ਕਲਾਵਾਂ ਅਤੇ ਕਾਰੀਗੀਰਾਂ ਦੀ ਸਹਾਇਤਾ ਲਈ ਸਰਕਾਰ ਦੁਆਰਾ ਪਹਿਲ ਕਦਮੀਆਂ ਚਲਾਈਆਂ ਗਈਆਂ ਹਨ ਜਿਵੇਂ ਕਿ ਉਹਨਾਂ ਨੂੰ ਕਰਜੇ ਦਿੱਤੇ ਜਾ ਰਹੇ ਹਨ ਸਬਸਿਡੀਆਂ ਅਤੇ ਫੰਡੀਗਾਂ ਦਿੱਤੀਆਂ ਜਾ ਰਹੀਆਂ ਹਨ ਪਰ ਮੇਰੇ ਹਿਸਾਬ ਨਾਲ ਕੁਝ ਕਲਾ ਕਿਸਮਾਂ ਹਨ ਜਿਹਨਾਂ ਨੂੰ ਵਧੇਰੇ ਮਾਨਤਾ ਦੀ ਲੋੜ ਹੈ ਜਿਵੇਂ ਕਿ ਛੋਟੇ ਛੋਟੇ ਕਲਾਕਾਰ ਸਾਡੇ ਜੋ ਅੱਜ ਕੱਲ੍ਹ ਕੰਮ ਕਰਦੇ ਨੇ ਉਹਨਾਂ ਨੂੰ ਕੁਝ ਜ਼ਿਆਦਾ ਬੈਨੀਫਿਟ ਹੋਣਾ ਚਾਹੀਦਾ ਜਿਵੇਂ ਕਿ ਕਰਜੇ ਸਬਸਿਡੀ ਸਬਸਿਡੀਆਂ ਅਤੇ ਫੰਡੀਗਾਂ ਆਦਿ ਜ਼ਿਆਦਾ ਦੇਣੇ ਚਾਹੀਦੇ ਹਨ ਅਤੇ ਉਹਨਾਂ ਲਈ